ਹਾਂਜੀ ਸਾਨੂੰ ਬਹੁਤ ਹੀ ਸੋਂ ਸ਼ੋਂਕ ਆ ਵੀ ਫੁ ਘਰ ਦੇ ਵਿੱਚ ਫੁੱਲ ਵੀ ਹੋਣ ਫ਼ਲ ਵੀ ਹੋਣ ਸਬਜ਼ੀਆਂ ਵੀ ਹੋਣ ਇਹ ਤਿੰਨੇ ਚੀਜਾਂ ਲਗਾਵਾਂਗੇ ਘਰਾਂ ਦੇ ਵਿੱਚ ਤਾਂ ਬਹੁਤ ਹੀ ਸ ਮਤਲਬ ਵੀ ਸੋਖਾ ਕੰਮ ਹੋ ਜਾਂਦਾ ਵਾ ਜਿਹੜੀ ਅਸੀਂ ਘਰ ਦੇ ਵਿੱਚ ਤਿੰਨ ਦੋ ਪਾਰਕਾਂ ਇੱਕ ਹਵੇ ਥੋੜ੍ਹੀ ਜਿਹੀ ਜਗ੍ਹਾ ਬਾਹਰ ਛੱਡੀ ਹੋਈ ਆ ਜਿਹਦੇ ਵਿੱਚ ਅਸੀਂ ਸਬਜ਼ੀਆਂ ਫ਼ਲ ਅਤੇ ਫੁੱਲ ਜਿਹੜੇ ਅਸੀਂ ਘਰ ਦੇ ਵਿੱਚ ਪਾਰਕ ਬਣਾਈ ਹੋਈ ਹੈ ਛੋਟੀ ਜਿਹੀ ਪਾਰਕ ਬਣਾਈ ਉਹਦੇ ਵਿੱਚ ਬਹੁਤ ਸੁੰਦਰ ਸੁੰਦਰ ਫੁੱਲ ਲਾਏ ਹੋਏ ਹਨ ਜਿਨ੍ਹਾਂ ਦੇ ਨਾਲ ਮਤਲਬ ਕਿ ਘਰ ਦੀ ਡੈਕ ਮਤਲਬ ਕਿ ਘਰ ਬਹੁਤ ਹੀ ਸੋਣਾ ਲੱਗਦਾ ਵਾ ਘਰ ਦੀ ਸਜਾਵਟ ਚੰਗੀ ਲੱਗਦੀ ਹੈ ਜਿਹੜੇ ਫ਼ਲ ਵਾ ਉਹ ਸਾਡੀ ਸਿਹਤ ਲਈ ਹੀ ਬਹੁਤ ਹੀ ਚੰਗੇ ਹੈ ਜਿਹੜੇ ਬਜ਼ਾਰੀ ਫ਼ਲ ਹੈ ਉਹ ਬਹੁਤ ਹੀ ਮਾੜੇ ਆ ਜਿਹੜੇ ਘਰ ਦੇ ਫ਼ਲ ਹਾ ਉਹ ਬਹੁਤ ਹੀ ਚੰਗੇ ਹੈ ਘਰ ਦੇ ਵਿਹੜੇ ਵਿਚ ਸਾਡਾ ਇੱਕ ਜਾਮਣ ਹੈ ਬਾਹਰ ਤਿੰਨ ਅਮਰੂਦ ਹੈ ਅੰਬ ਦਾ ਬੂਟਾ ਵਾ ਮਸੰਮੀ ਦਾ ਬੂਟਾ ਵਾ ਆੜੂ ਦਾ ਬੂਟਾ ਵਾ ਅੰਬ ਦਾ ਮਤਲਬ ਕਿ ਜਿਹੜੇ ਘਰ ਦੇ ਫ਼ਲ ਵਾ ਉਹ ਬਹੁਤ ਹੀ ਵਧੀਆ ਵਾ ਸਾਨੂੰ ਘਰ ਦੇ ਫ਼ਲ ਖਾਣੇ ਹੀ ਬਹੁਤ ਹੀ ਵਧੀਆ ਲੱਗਦੇ ਹਨ ਸਾਡੇ ਘਰ ਦੇ ਨਾਲ ਹੀ ਇੱਕ ਥੋੜ੍ਹੀ ਜਿਹੀ ਹਵੇਲੀ ਹੈ ਛੋਟੀ ਜਿਹੀ ਓਹਦੇ ਵਿੱਚ ਅਸੀਂ ਸਬਜ਼ੀਆਂ ਲਗਾਈਆਂ ਹੋਈਆਂ ਸਬਜ਼ੀਆਂ ਘਰ ਦੀਆਂ ਸਬਜ਼ੀਆਂ ਹੀ ਬਹੁਤ ਹੀ ਸੁਆਦ ਲੱਗਦੀਆਂ ਜਿਹੜੀਆਂ ਬਜ਼ਾਰੀ ਸਬਜ਼ੀਆਂ ਵਾ ਉਹ ਬਹੁਤ ਹੀ ਸੁਆਦ ਨਹੀਂ ਹੀ ਬਣਦੀਆਂ ਜਿਹੜੀ ਘਰ ਦੀ ਸਬਜ਼ੀ ਹੈ ਓ ਉਹ ਹਮੇਸ਼ਾ ਹੀ ਸਵਾਦ ਬਣਦੀ ਹੈ ਅਸੀਂ ਸਬਜ਼ੀਆਂ ਦੇ ਵਿੱਚ ਘੀਆ ਭਿੰਡੀ ਤੋਰੀ ਕਰੇਲੇ ਹਰੀ ਮਿਰਚ ਮਤਲਬ ਕਿ ਗਰਮੀ ਵਾਲੀਆਂ ਹਰੇਕ ਹੀ ਸਬਜ਼ੀਆਂ ਲਗਾਈਆਂ ਹੋਈਆਂ ਹਨ ਵੀ ਜਿਹੜਾ ਵੀ ਸਾਨੂੰ ਬਜ਼ਾਰ ਤੋਂ ਸਬਜ਼ੀ ਨਾ ਹੀ ਲਿਆਈਏ ਅਤੇ ਘਰ ਦੀ ਹੀ ਸਬਜ਼ੀ ਖਾਈਏ ਕੱਦੂ ਲਗਾਏ ਹੋਏ ਨੇ ਜਿਹਦੇ ਨਾਲ ਅਸੀਂ ਘਰ ਦੇ ਵਿੱਚ ਹੀ ਦਹੀਂ ਰਾਇਤਾ ਕਰ ਸਕਦੇ ਹਾਂ ਜਿੱਦਾ ਅਸੀਂ ਜਿਵੇਂ ਵੀ ਘੀਆ ਤੋਰੀ ਵੀ ਲਗਾਈ ਹੋਈ ਜਦੋਂ ਵੀ ਮਤਲਬ ਕਿ ਸਾਨੂੰ ਬਾਹਰ ਦੀ ਚੀਜ਼ ਨਹੀਂ ਚੰਗੀ ਲੱਗਦੀ ਹਨ ਘਰ ਦਾ ਹੀ ਜਿਹੜੀ ਸਬਜ਼ੀ ਹੈ ਉਹ ਚੰਗੀ ਲੱਗਦੀ ਹੈ ਇਸ ਲਈ ਸਾਨੂੰ ਤਿੰਨੇ ਹੀ ਚੀਜ਼ਾਂ ਘਰ ਦੇ ਵਿੱਚ ਲਗਾਉਣੀਆਂ ਹੀ ਬਹੁਤ ਹੀ ਜ਼ਰੂਰੀ ਹਨ ਇਹਦੇ ਨਾਲ ਸਾਰਾ ਹੀ ਵਾਤਾਵਰਨ ਸੋਹਣਾ ਲੱਗਦਾ ਵਾ ਘਰ ਦਾ ਮਹੌਲ ਸੋਹਣਾ ਲੱਗਦਾ ਵਾ